ਸੱਭਿਆਚਾਰ ਸੱਭਿਆਚਾਰ ਹੈ ਉਹ ਸਮਾਜ ਦਾ ਆਇਨਾ ਹੁੰਦਾ ਏ ਆਂ ਔਰ ਅਗਰ ਅਸੀਂ ਗੱਲ ਕਰੀਏ ਪੰਜਾਬ ਦੇ ਸਭ ਸੱਭਿਆਚਾਰ ਦੀ ਤਾਂ ਉਹਦੀ ਤਾਂ ਗੱਲ ਹੀ ਅਲੱਗ ਹੈ ਇਥੋਂ ਦਾ ਪਹਿਰਾਵਾ ਇੱਥੋਂ ਦੇ ਮੰਨੋਰੰਜਨ ਇੱਥੋਂ ਦਾ ਰੀਤੀ ਰਿਵਾਜ ਉਹ ਸਭ ਤੋਂ ਹੀ ਅਲਹਿਦਾ ਹੈ ਅਤੇ ਅੱਜ ਸਮੇਂ ਵਿੱਚ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਸੱਭਿਆਚਾਰ ਆ ਇਸ ਇਸਨੂੰ ਪ੍ਰਭਾਵਿਤ ਕੀਤਾ ਹੋਇਆ ਏ ਆ ਦੂਸਰੇ ਦੇਸ਼ਾਂ ਦੇ ਸੱਭਿਆਚਾਰ ਨੇ ਜਿਹਦੇ ਨਾਲ ਇੱਕ ਕਹਿ ਲਉ ਕਿ ਜਿਹੜੀ ਰੂੜੀਵਾਦਤਾ ਸੀ ਉਹ ਖਤਮ ਹੋ ਗਈ ਹੈ ਕਿਉਂਕਿ ਇਹਦੇ ਨਾਲ ਪੰਜਾਬ ਨੇ ਦੂਸਰੇ ਸੱਭਿਆਚਾਰ ਨੂੰ ਅਪਣਾ ਕੇ ਇੱਕ ਧਨਾਤਮਕ ਰੂਪ ਹੀ ਧਾਰਨ ਕੀਤਾ ਹੋਇਆ ਹੈ